ਹਾਂਜੀ ਹਾਂਜੀ ਸਰ ਹਾਂਜੀ ਸਰ ਹਾਂਜੀ ਕੀ ਕੀ ਲੈਣਾ ਸਰ ਠੀਕ ਸਰ ਸਭ ਦੇ ਹਰ ਇਕ ਸਬਜ਼ੀ ਦੇ ਅਲੱਗ ਅਲੱਗ ਰੇਟ ਨੇ ਇੱਕ ਵਾਰੀ ਤੁਸੀਂ ਉੱਥੇ ਆ ਜਾਈਓ ਅਤੇ ਫਿਰ ਤੁਹਾਨੂੰ ਅਸੀਂ ਸਾਰੇ ਦੱਸ ਦਵਾਂਗੇ ਰੇਟ ਪਿਆਜ ਸੱਠ ਰੁਪਈਏ ਕਿਲੋ ਚੱਲ ਰਹੇ ਨੇ ਅਤੇ ਟਮਾਟਰ ਪੰਜਾਹ ਰੁਪਈਆ ਹੈਗਾ ਜੀ ਪੱਤਾ ਗੋਭੀ ਅੱਸੀ ਰੁਪਈਏ ਬਾਕੀ ਜਿਵੇਂ ਤੁਸੀਂ ਆਓਗੇ ਮੌਕੇ 'ਤੇ ਦੇਖ ਲਾਂਗੇ ਠੀਕ ਹੈ ਜੀ ਹਾਂਜੀ ਸਰ ਆ ਜਾਂਗੇ ਰੇਟ ਬਦਲਦੇ ਰਹਿੰਦੇ ਬਾਕੀ ਦੇਖ ਲਿਓ ਭੇਜ ਦਾਂਗੇ ਅਸੀਂ ਲਿਸਟ ਵੀ ਥੈਂਕ ਯੂ ਸਰ